ਨਹੀਂ ਹੁਣ ਤੱਕ ਮੈਂ ਕੋਈ ਜ਼ਿਆਦਾ ਵੱਡੀ ਮੂਰਤੀ ਨਹੀਂ ਬਣਾਈ ਹੈ ਅਤੇ ਇਸ ਵਿੱਚ ਮੇਰਾ ਕੋਈ ਖਾਸ ਅਨੁਭਵ ਨਹੀਂ ਹੈ